ਮੋਹਾਲੀ ਜ਼ਿਲ੍ਹੇ ਵਿੱਚ ਬਹੁਤ ਹੀ ਵਧੀਆ ਵਾਤਾਵਰਨ ਹੈ ਚਾਰੇ ਪਾਸੇ ਦਰੱਖਤ ਨਾਲ਼ ਮੋਹਾਲੀ ਜ਼ਿਲ੍ਹਾ ਬਿਲਕੁਲ ਹਰਿਆ ਭਰਿਆ ਪਿਆ ਹੈ ਅਤੇ ਸੜਕ ਦੇ ਆਲ਼ੇ ਦੁਆਲ਼ੇ ਵੀ ਫੁੱਲ ਬੂਟੇ ਨਾਲ਼ ਸੜਕਾਂ ਦੀ ਹੋਰ ਸ਼ੋਭਾ ਵੱਧ ਗਈ ਹੈ ਮੋਹਾਲੀ ਜ਼ਿਲ੍ਹੇ ਵਿੱਚ ਦਰੱਖਤ ਹੋਣ ਕਰਕੇ ਇੱਥੇ ਹਰ ਹਫਤੇ ਵਿੱਚ ਜਾਂ ਮਹੀਨੇ ਵਿੱਚ ਮੋਸ ਮੋਨਸੂਨ ਆਉਂਦਾ ਰਹਿੰਦਾ ਹੈ ਜਿਸ ਕਰਕੇ ਇੱਥੇ ਦਾ ਵਾਤਾਵਰਨ ਬਹੁਤ ਸ਼ੁੱਧ ਰਹਿੰਦਾ ਹੈ ਅਤੇ ਆਵਾ ਜਦੋਂ ਪ੍ਰਦੂਸ਼ਣ ਹੁੰਦਾ ਹੈ ਤਾਂ ਉਹ ਸ਼ੁੱਧ ਵਾਤਾਵਰਨ ਵਿੱਚ ਇੰਨਾਂ ਜ਼ਿਆਦਾ ਲੋਕਾਂ ਨੂੰ ਜ਼ਿਆਦਾ ਪ੍ਰੇਸ਼ਾਨ ਨਹੀਂ ਕਰਦਾ ਅਤੇ ਮੋਹਾਲੀ ਜ਼ਿਲ੍ਹੇ ਦੇ ਨਗਰਪਾਲਿਕਾ ਦਾ ਕੰਮ ਵੀ ਬਹੁਤ ਵਧੀਆ ਹੈ ਸਫਾਈ ਪੂਰੀ ਹੁੰਦੀ ਹੈ ਜਿਸ ਕਰਕੇ ਮੋਹਾਲੀ ਜ਼ਿਲ੍ਹੇ ਵਿੱਚ ਬਿਮਾਰੀ ਦੇ ਵੀ ਕੇਸ ਬਹੁਤ ਘੱਟ ਆਉਂਦੇ ਹਨ ਅਤੇ ਕਿਤੇ ਵੀ ਕੋ ਕਿਤੇ ਵੀ ਖੁੱਲ੍ਹਾ ਕੂੜਾ ਜਾਂ ਇੱਦਾਂ ਦਾ ਕੁਛ ਵੀ ਨਹੀਂ ਦਿਸਦਾ ਧੰਨਵਾਦ